ਹੈਲੋ ਹਾਂਜੀ ਮੈਮ ਹਾਂਜੀ ਮੈਮ ਸੋਰੀ ਮੈਨੂੰ ਨਾ ਯਾਦ ਭੁੱਲ ਗਈ ਇਹ ਨਾ ਕੁੱਝ ਕ ਕੁੱਝ ਦਿਨਾਂ ਤੋਂ ਬਾਹਰ ਗਏ ਸੀ ਅਤੇ ਮੈਨੂੰ ਯ ਯਾਦ ਭੁੱਲ ਗਿਆ ਅਤੇ ਮੈਮ ਕੋਈ ਨਹੀਂ ਹਾਂਜੀ ਮੈਮ ਕੋਈ ਨਹੀਂ ਕੱਲ੍ਹ ਨੂੰ ਬੱਚੇ ਹੱਥ ਹੀ ਭੇਜ ਦੇਵਾਂਗੀ ਅਤੇ ਜੇ ਤੁਹਾਨੂੰ ਅੱਜ ਹੀ ਚਾਹੀਦਾ ਤਾਂ ਮੈਂ ਫਿਰ ਅ ਔਨਲਾਈਨ ਹੀ ਪੇਮੈਂਟ ਕਰ ਦਿੰਦੀ ਤੁਹਾਨੂੰ ਹਾਂਜੀ ਨਹੀਂ ਮੈਮ ਡਾਂਸ ਠੀਕ ਵਧੀਆ ਕਰ ਰਿਹਾ ਨਾ ਹਾਂਜੀ ਮੈਮ ਭੇਜ ਦਾਂਗੇ